ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਤੋਂ ਬੈੱਡਸ਼ੀਟ ਦਾ ਔਡਰ ਮੰਗਾਇਆ ਸੀ ਮੈਨੂੰ ਉਹ ਔਡਰ ਮਿਲ ਗਿਆ ਸੀ ਉਹ ਉੱਥੇ ਹੀ ਕਿ ਦਸ ਦਿਨਾਂ ਦੇ ਵਿੱਚ ਆਡਰ ਆ ਜਾਵੇਗਾ ਪਰ ਮੈਨੂੰ ਇਹ ਆਡਰ ਛੇ ਸੱਤ ਦਿਨ ਵਿੱਚ ਹੀ ਮਿਲ ਗਿਆ ਸੀ ਜਿਹੜਾ ਇਹ ਆਡਰ ਮੈਂ ਬੈੱਡਸ਼ੀਟ ਮੰਗਵਾਇਆ ਸੀ ਉਹ ਬਿਲਕੁਲ ਉਹੀ ਸਨ ਉਹਨਾਂ ਦਾ ਰੰਗ ਵੀ ਉਹੀ ਸੀ ਅਤੇ ਉਹਨਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਇਹ ਬੈੱਡਸ਼ੀਟ ਮੇਰੇ ਬੈੱਡ 'ਤੇ ਬਹੁਤ ਜੱਚ ਰਹੀਆਂ ਹਨ ਅਤੇ ਇਹ ਮੇਰੇ ਪਰਿਵਾਰ 'ਚ ਬਹੁਤ ਪਸੰਦ ਆਈਆਂ ਹਨ ਮੈਂ ਆਪਣੇ ਦੋਸਤਾਂ ਨੂੰ ਵੀ ਦੱਸਾਂਗੀ ਕਿ ਉਹ ਤੁਹਾਡੇ ਤੋਂ ਹੀ ਇਹ ਆਡਰ ਲੈਣ ਮੈਨੂੰ ਸੱਚਮੁੱਚ ਹੀ ਤੁਹਾਡੇ ਆਡਰ 'ਤੇ ਬਹੁਤ ਖੁਸ਼ੀ ਹੋਈ ਹੈ